ਸਤਿ ਸ਼੍ਰੀ ਅਕਾਲ ਪੰਜਾਬੀ ਅਤੇ ਬੰਗਾਲੀ ਦੋਵੇਂ ਵੱਖਰੇ ਵੱਖਰੇ ਭਾਸ਼ਾਵਾਂ ਹਨ ਪਰ ਇਹ ਦੋਨਾਂ ਦੇ ਵਿੱਚ ਇੱਕ ਸਮਾਨਤਾ ਜਾਂ ਲਿੰਕ ਹੈਗਾ ਜੋ ਕਿ ਸੰਸਕ੍ਰਿਤ ਦਾ ਲਿੰਕ ਹੈ ਇਹ ਦੋਵੇਂ ਲੈਂਗੁਏਜ ਆ ਦੋਨੋਂ ਐਕਸਟਰੀਮ ਸਾਈਡ ਦੇ ਐਜੇਸ ਹੈ ਆਫ ਇੰਡੀਓ ਰਾਇਲ ਲੈਗੁਏਜ ਫੈਮਲੀ ਯਾਨੀ ਕਿ ਜਿਹੜੀ ਇੰਡੋ ਅਰਾਇਨ ਲੈਗੁਏਜ ਫੈਮਲੀ ਹੈ ਇਹ ਦੋਨੋਂ ਲੈਗੁਏਜਾਂ ਉਹਦੇ ਕੰਢੇ 'ਤੇ ਨੇ ਪੰਜਾਬੀ ਹੈ ਜਿਹੜੇ ਉਹ ਵੈਸਟ ਸਾਈਡ 'ਤੇ ਹੈ ਜਿਹੜੇ ਬੰਗੋਲੀ ਹੈ ਉਹ ਈਸਟ ਸਾਈਡ 'ਤੇ ਹੈ ਜਦੋਂ ਇੰਡੀਆ ਪਾਕਿਸਤਾਨ ਦਾ ਉਹ ਵਿਭਾਜਨ ਹੋਇਆ ਜਾਂ ਜਦੋਂ ਦੋਨਾਂ ਦੀ ਪਾਰਟੀਸ਼ਨ ਹੋਈ ਉਹਦੇ ਦੌਰਾਨ ਜਿਹੜਾ ਇੰਡੀਆ ਸੀ ਉਹ ਈਸਟ ਵਾਲੇ ਪਾਸੇ ਚਲ ਗਿਆ ਜਿਹੜਾ ਬੈਗੋ ਅ ਪਾਕਿਸਤਾਨ ਸੀ ਉਹ ਵੈਸਟ ਵਾਲੇ ਪਾਸੇ ਚਲ ਗਿਆ ਜਿਹੜਾ ਬੰਗੋਲੀਆਂ ਨੇ ਉਹਨਾਂ ਨੇ ਲੜਾਈ ਲੜੀ ਉਰਦੂ ਦੀ ਉਰਦੂ ਨੂੰ ਇੰਪਲੀਮੈਂਟ ਕਰਨ ਵਾਸਤੇ ਜਿਸ ਕਰਕੇ ਉਰਦੂ ਇੰਪਲੀਮੈਂਟ ਹੋਈ ਬਾਂਗਲਾਦੇਸ਼ ਦੇ ਵਿੱਚ ਅਤੇ ਬਾਂਗਲਾ ਦੇ ਬੰਗਾਲੀ ਇੱਕ ਵੱਡੀ ਲੈਂਗੁਏਜ ਹੈ ਜਿਹਦੇ ਵਿੱਚ ਦੋ ਸੌ ਪੰਜਾਹ ਮਿਲੀਅਨ ਲੋਕ ਬੋਲਦੇ ਹਨ ਅਤੇ ਪੰਜਾਬੀ ਦੀ ਲੈਂਗੁਏਜ ਉਹ ਅੱਧੀ ਹੈ ਸਿਰਫ ਉਹ ਇਕ ਸੌ ਵੀਹ ਮਿਲੀਅਨ ਹੈ ਅਤੇ ਜਿਹੜੀ ਬੰਗਾਲੀ ਹੈ ਉਹ ਲੰਬੇ ਸਮੇਂ ਤੱਕ ਟਿਕਣ ਵਾਸਤੇ ਵੀ ਚੰਗੀ ਹੈ ਕਿਉਂਕਿ ਇਹ ਓਫੀਸ਼ੀਅਲ ਲੈਂਗੁਏਜ ਹੈ ਵਿਦ ਢਾਈ ਸੌ ਮਿਲੀਅਨ ਸਪੀਕਰ ਅਤੇ ਉਹਦੇ ਵਿ ਢਾਈ ਸੌ ਸਪੀਕਰ ਹੈਗੇ ਨੇ ਬੰਗਲਾਦੇਸ਼ ਅਤੇ ਵੈਸਟ ਬੰਗੋਲ ਦੇ ਵਿੱਚ ਪੰਜਾਬੀ ਜਿਹੜੀ ਉਹ ਓਨਲੀ ਲੈਂਗੁਏਜ ਆ ਜਿਹੜੀ ਸਿਰਫ ਪੰਜਾਬ 'ਚ ਬੋਲੀ ਜਾਂਦੀ ਹੈ ਜਿਹਦੇ ਵਿੱਚ ਸਿਰਫ ਅਠਾਈ ਮਿਲੀਅਨ ਲੋਕ ਨੇ ਅਪਰੋਕਸ ਹੁਣ ਇਹਨਾਂ ਵਿੱਚ ਇੱਕ ਇਹ ਵੀ ਹੈਗਾ ਕਿ ਜਿਹੜੀ ਪੰਜਾਬੀ ਅਤੇ ਬੰਗੋਲੀ ਹੈ ਉਹ ਸੰਸਕ੍ਰਿਤ ਨਾਲ ਬਹੁਤ ਜ਼ਿਆਦਾ ਲਿੰਕ ਕਰਦੀ ਹੈ ਸੋ ਇਸ ਕਰਕੇ ਉਹ ਦੋਨਾਂ ਦੇ ਵਿੱਚ ਦਾ ਸਭ ਤੋਂ ਵੱਡਾ ਲਿੰਕ ਸੰਸਕ੍ਰਿਤ ਦਾ ਹੀ ਬਣਦਾ ਹੈਗਾ